ਮੇਰਾ ਨੈਗੇਟਿਵ ਐਕਸਪੀਰੀਐਂਸ ਇਹ ਰਿਹਾ ਹੈ ਕਿ ਮੈਂ ਕੁਛ ਸਮਾਂ ਪੇ ਪਹਿਲਾਂ ਕੂਲਰ ਮੰਗਵਾਇਆ ਸੀ ਔਨਲਾਈਨ ਮੈਂ ਆਪਣੇ ਦੋਸਤਾਂ ਦੇ ਕਹਿਣ 'ਤੇ ਕੂਲਰ ਮੰਗਵਾਇਆ ਸੀ ਕਿਉਂਕਿ ਉਹਨਾਂ ਦੇ ਅਕੋਰਡਿੰਗ ਕੂਲਰ ਵੀ ਅੱਜ ਕੱਲ੍ਹ ਏ ਸੀ ਵਰਗਾ ਹੀ ਕੰਮ ਕਰਨ ਲੱਗੇ ਨੇ ਏ ਸੀ ਹਰ ਘਰ ਦੇ ਵਿੱਚ ਹਰ ਕਮਰੇ ਦੇ ਵਿੱਚ ਵਾਰਾ ਨਹੀਂ ਖਾਂਦਾ ਤਾਂ ਜੋ ਆਪਣੀ ਪੋਕਿਟ ਨੂੰ ਸਾਂਭਣ ਲਈ ਮੈਂ ਕੂਲਰ ਮੰਗਵਾਇਆ ਸੀ ਅਤੇ ਬਟ ਉਹ ਮੈਂ ਔਨਲਾਈਨ ਮੰਗਵਾਇਆ ਸੀਗਾ ਜਿਹਦੇ ਵਿੱਚ ਮੈਨੂੰ ਸੈਟਿਸਫੈਕਸ਼ਨ ਨਹੀਂ ਮਿਲੀ ਕਿਉਂਕਿ ਔਨਲਾਈਨ ਉਹਨਾਂ ਨੇ ਕਿਹਾ ਸੀਗਾ ਕਿ ਇਹ ਬਿਜਲੀ ਦੀ ਖਪਤ ਘੱਟ ਕਰਦਾ ਹੈ ਅਤੇ ਇਹ ਬਹੁਤ ਤੇਜ਼ ਹਵਾ ਦਿੰਦਾ ਹੈ ਇਹ ਰੋਟੇਟ ਵੀ ਹੁੰਦਾ ਹੈ ਬਟ ਤਾਂ ਜੋ ਮੈਨੂੰ ਕੋਈ ਸੈਟਿਸਫੈਕਸ਼ਨ ਨਹੀਂ ਮਿਲੀ ਇੱਕ ਤਾਂ ਡਿਲੀਵਰੀ ਬੁਆਏ ਵੀ ਐਡਾ ਬੇਕਾਰ ਸੀਗਾ ਡਿਲੀਵਰੀ ਬੁਆਏ ਕੂਲਰ ਦੀ ਡਿਲੀਵਰੀ ਥੱਲੇ ਹੀ ਦੇ ਗਿਆ ਮੈਨੂੰ ਤਾਂ ਮੈਨੂੰ ਬਾਹਰੋਂ ਬੰਦੇ ਸੱਦ ਕੇ ਉਹਨਾਂ ਨੂੰ ਵੱਖ ਪੈਸੇ ਦੇ ਕੇ ਕੂਲਰ ਨੂੰ ਆਪਣੇ ਉੱਤੇ ਜਿੱਥੇ ਮੈਂ ਰਹਿੰਦੀ ਹਾਂ ਉੱਥੇ ਚੜਾਉਣਾ ਪਿਆ ਫਿਰ ਜਦੋਂ ਮੈਂ ਉਹ ਪੀਸ ਨੂੰ ਖੋਲਿਆ ਤਾਂ ਉਹ ਪੀਸ ਡੈਮੇਜ ਨਿਕਲਿਆ ਮੇਰੀ ਕੰਪਨੀ ਤੋਂ ਬਿਨਤੀ ਹੈ ਮੈਂ ਫਲਿੱਪਕਾਰਟ ਤੋਂ ਔਡਰ ਕੀਤਾ ਸੀਗਾ ਬਿਨਤੀ ਹੈ ਕਿ ਆਹ ਪੀਸ ਵਾਪਸ ਲੈ ਜਾਓ ਮੇਰੇ ਤਾਂ ਆਹ ਕਿਸੇ ਕੰਮ ਜੋਗਾ ਨਹੀਂ ਹੈਗਾ ਅਤੇ ਮੇਰਾ ਤਾਂ ਬਹੁਤ ਹੀ ਮਾੜਾ ਐਕਸਪੀਰੀਐਂਸ ਰਿਹਾ ਹੈ ਔਨਲਾਈਨ ਇਲੈਕਟਰੋਨਿਕਸ ਦਾ ਸਮਾਨ ਤਾਂ ਬਿਲਕੁਲ ਨਹੀਂ ਮੰਗਵਾਉਣਾ ਚਾਹੀਦਾ ਅਤੇ ਮੇਰੀਆਂ ਤਾਂ ਸਾਰੀਆਂ ਗਰਮੀਆਂ ਬਹੁਤ ਹੀ ਬੇਕਾਰ ਨਿਕਲੀਆਂ ਨੇ ਤਾਂ ਪਲੀਜ਼ ਤੁਹਾਨੂੰ ਦਰਖਾਸਤ ਹੈ ਕਿ ਔਨਲਾਈਨ ਨਾ ਮੰਗਵਾਓ